ਸਤਿ ਸ਼੍ਰੀ ਆਕਾਲ ਜੀ ਸਤਿ ਸ਼੍ਰੀ ਆਕਾਲ ਜੀ ਸ਼ੌਪ ਤੋਂ ਬੋਲ ਰਹੇ ਹੋ ਹਾਂਜੀ ਮੈਮ ਕੁੜਤੇ ਪਜਾਮਿਆਂ ਬਾਰੇ ਪੁੱਛਣਾ ਸੀ ਤੁਹਾਡੇ ਕੋਲੋਂ ਕਿਵੇਂ ਕਿਵੇਂ ਦੇ ਕੱਪੜੇ ਮਿਲ ਜਾਂਦੇ ਹੈ ਅੱਛਾ ਮੈਮ ਅਤੇ ਮੈਮ ਉਹਨਾਂ ਬਾਰੇ ਹਾਂਜੀ ਮੈਮ ਅਤੇ ਓਵੇ ਟਿੱਕਿਆਂ ਬਾਰੇ ਪੁੱਛਣਾ ਸੀ ਟਿੱਕੇ ਸੱਗੀ ਫੁੱਲ ਕੈਂਠੇ ਵਗੈਰਾ ਹੈਗੇ ਹੈ ਤੁਹਾਡੇ ਕੋਲ ਅੱਛਾ ਜੀ ਹਾਂਜੀ ਅੱਛਾ ਹਾਂਜੀ ਕੀ ਵੈਸੇ ਕੀ ਪ੍ਰਾਈਜ਼ ਹੋ ਸਕਦਾ ਕਿੰਨੇ ਕੁ ਤੱਕ ਹੋ ਸਕਦੇ ਵਧੀਆ ਕੁਆਲਿਟੀ 'ਚ ਹਾਂਜੀ ਮੈਂ ਉਹਦਾ ਟਿੱਕੇ ਵਗੈਰਾ ਦਾ ਜੀ ਸੱਗੀ ਫੁੱਲ ਵਗੈਰਾ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਹੋਰ ਕੀ ਕੀ ਮਿਲ ਸਕਦਾ ਜੀ ਤੁਹਾਡੀ ਦੁਕਾਨ ਤੋਂ ਠੀਕ ਹੈ ਜੀ ਫਿਰ ਆ ਗਏ ਠੀਕ ਹੈ ਜੀ ਆ ਕੇ ਠੀਕ ਹੈ ਜੀ ਹਾਂਜੀ ਆ ਗਏ ਫਿਰ ਮੈਂ ਦੇਖ ਲੈਂਦੀ ਹਾਂ ਜੀ ਚੈੱਕ ਕਰ ਲੈਂਦੀ ਹਾਂ ਜੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਜੀ